ਹੈਲੋ ਸਤਿ ਸ਼੍ਰੀ ਅਕਾਲ ਮੈਮ ਹਾਂਜੀ ਮੈਮ ਹਾਂਜੀ ਹਾਂਜੀ ਜੀ ਤੁਸੀਂ ਕਿਵੇਂ ਵਾਸਤੇ ਸਾਈਕਲ ਦੇਖਣਾ ਚਾਹੁੰਦੇ ਹੋ ਅਸੀਂ ਤੇ ਮੈਮ ਤੁਸੀਂ ਕਿੰਨੀ ਕ ਰੇਂਜ ਵਿੱਚ ਦੇਖਣਾ ਚਾਹੁੰਦੇ ਹੋ ਅੱਛਾ ਜੀ ਪਰ ਜਿਹੜੇ ਮੈਮ ਸਾਡੇ ਪ੍ਰੀਮੀਅਮ ਸਾਈਕਲ ਹੈਗੇ ਆ ਨਾ ਉਹ ਤੁਹਾਨੂੰ ਦੱਸ ਤੋਂ ਉੱਪਰ ਹੀ ਮਿਲਣਗੇ ਮਤਲਬ ਜਿਆਦਾ ਰੇਂਜ ਨਹੀਂ ਹੋਏਗੀ ਤੁਸੀਂ ਲਗਾ ਲਓ ਬਾਰਾਂ ਤੋਂ ਪੰਦਰਾਂ ਦੇ ਵਿੱਚ ਵਿੱਚ ਜਿਹੜੀ ਸਾਡੀ ਸਪੈਸ਼ਲ ਸਾਈਕਲ ਆਏ ਨੇ ਹਾਂਜੀ ਜੀ ਮੈਡਮ ਮਾਣ ਤਾ ਅਸੀਂ ਜਰੂਰ ਕਰਾਂਗੇ ਤੁਹਾਡਾ ਤਾਂ ਜੀ ਆਇਆਂ ਨੂੰ ਤੁਹਾਡਾ ਪਰ ਦਰਅਸਲ ਗੱਲ ਹ ਨਾ ਕਿ ਜਿਹੜੇ ਸਾਡੇ ਸਾਈਕਲ ਆ ਉਹ ਬਾਕੀਆਂ ਨਾਲੋਂ ਬੜੇ ਵੱਖ ਆ ਤੁਹਾਡੇ ਬੱਚੇ ਨੂੰ ਕੋਈ ਵੀ ਦਿੱਕਤ ਨਹੀਂ ਆਏਗੀ ਵੀ ਬੜਾ ਕੰਫਰਟੇਬਲ ਹੀ ਉਹ ਚਲਾ ਸਕਦਾ ਸਾਈਕਲ ਇਸ ਲਈ ਤੁਹਾਨੂੰ ਥੋੜਾ ਜਿਹਾ ਤਾਂ ਆਪਣੀ ਰੇਂਜ ਵਿੱਚ ਦੇਖਣਾ ਹੀ ਪਏਗਾ ਕੁਆਲਿਟੀ ਸਾਡੀ ਗਰੰਟੀ ਹੈ ਇਸ ਤੋਂ ਵੱਧ ਕੇ ਤੁਸੀਂ ਕਿਸੇ ਵੀ ਚੱਲ ਜਾਓ ਬਾਜ਼ਾਰ ਵਿੱਚ ਤੁਹਾਨੂੰ ਇਸ ਤੋਂ ਵਧੀਆ ਸਾਈਕਲ ਕਿਤੇ ਨਹੀਂ ਮਿਲੇਗਾ ਮੈਡਮ ਤੁਹਾਨੂੰ ਵੱਧ ਤੋਂ ਵੱਧ ਗਿਆਰਾਂ ਤੱਕ ਪੈ ਜਾਏਗਾ ਤੁਸੀਂ ਸਪੈਸ਼ਲ ਸਾਡੇ ਬੱਚਿਆਂ ਦੀ ਰੈਫਰੈਂਸ ਤੇ ਆਏ ਹੋ ਇਸ ਕਰਕੇ ਸਮਾਨ ਰੱਖਦੇ ਪਰ ਨਾ ਕਿਸੇ ਹੋਰ ਆਪਾਂ ਕਿਸੇ ਨੂੰ ਵੀ ਇਦਾਂ ਦੀ ਪ੍ਰਾਈਜ ਦੇ ਉਹ ਨਹੀਂ ਕੁਝ ਕਟੌਤੀ ਨਹੀਂ ਕਰਦੇ ਆਪਾਂ ਤੁਸੀਂ ਸਾਡੇ ਸਪੈਸ਼ਲ ਮਹਿਮਾਨ ਹੋ ਇਸ ਕਰਕੇ ਅਸੀਂ ਤੁਹਾਨੂੰ ਗਿਆਰਾਂ ਹਜਾਰ ਸਾਢੇ ਗਿਆਰਾਂ ਹਜਾਰ ਤੱਕ ਵੱਧ ਤੋਂ ਵੱਧ ਕਰ ਸਕੇ ਉਸ ਤੋਂ ਘੱਟ ਨਹੀਂ ਆਪਾਂ ਜਾ ਸਕਦੇ

ਮੈਡਮ ਇਦਾਂ ਇੱਕ ਕੰਮ ਕਰੋ ਤੁਸੀਂ ਨਾ ਸਾਡੀ ਪਹਿਲੇ ਦੁਕਾਨ ਤੇ ਇੱਕ ਵਾਰ ਆ ਕੇ ਦੇਖ ਲਓ ਕਿਹੋ ਜਿਹਾ ਤੁਹਾਨੂੰ ਰੰਗ ਚਾਹੀਦਾ ਕਿੱਦਾਂ ਦਾ ਤੁਹਾਡੇ ਡਿਮਾਂਡ ਚ ਹੈਗੇ ਆ ਫਿਰ ਉਸਦੇ ਅਕੋਰਡਿੰਗ ਅਸੀਂ ਦੇਖ ਲਵਾਂਗੇ ਕੀ ਕਰਨਾ ਕੀ ਤੁਸੀਂ ਇੱਕ ਵਾਰ ਸਾਡੀ ਦੁਕਾਨ ਤੇ ਆਇਓ ਅੱਛਾ ਜੀ ਹੋ ਸਕਦਾ ਪਰ ਕਈ ਵਾਰ ਨਾ ਬੰਦਾ ਆਪ ਆ ਕੇ ਦੇਖੇ ਕਈ ਵਾਰ ਫੋਟੋ ਚ ਰੰਗ ਕਈ ਹੋਰ ਤਰਾਂ ਦਾ ਦਿਖਦਾ ਅਸਲ ਵਿੱਚ ਕੁਝ ਹੋਰ ਚੀਜ਼ ਹੁੰਦੀ ਹ ਉਹ ਆ ਕੇ ਦੇਖਿਆ ਅਸੀਂ ਭਿਜਵਾ ਦਵਾਂਗੇ ਬਾਅਦ ਚੋਂ ਤੁਹਾਨੂੰ ਪਸੰਦ ਨਹੀਂ ਆਏਗਾ ਤੇ ਫਿਰ ਉਹ ਬਾਅਦ ਚੋਂ ਦਿੱਕਤ ਦੀ ਗੱਲ ਬਣ ਜਾਂਦੀ ਆ ਇਸ ਕਰਕੇ ਮੈਂ ਬੇਨਤੀ ਕਰਦੀ ਆ ਵੀ ਤੁਸੀਂ ਇੱਕ ਵਾਰ ਦੁਕਾਨ ਤੇ ਆ ਜਾਓ ਫਿਰ ਉਸ ਤੋਂ ਬਾਅਦ ਤੁਹਾਨੂੰ ਜੋ ਲੱਗਦਾ ਸਹੀ ਉਹ ਹੋ ਜਾਏ ਮੈਮ ਐਤਵਾਰ ਨੂੰ ਤਾਂ ਬੰਦ ਹੁੰਦਾ ਸ਼ਨੀਵਾਰ ਤੁਸੀਂ ਆ ਸਕਦੇ ਅੱਛਾ ਜੀ ਹਾਂਜੀ ਹਾਂਜੀ ਤੁਸੀਂ ਇੱਕ ਵਾਰ ਦੱਸ ਦਿਓ ਸਾਨੂੰ ਉਸ ਅਕੋਰਡਿੰਗ ਆਪਾਂ ਫਿਰ ਦੇਖ ਲਾਂਗੇ ਠੀਕ ਐ ਜੀ ਮੈਡਮ ਹਾਂਜੀ ਸਾਡੇ ਕੋਲ ਸਾਰੇ ਤਰਾਂ ਦੀ ਵਰਾਇਟੀ ਹੈਗੀ ਤੁਸੀਂ ਆਓ ਸਾਡੀ ਦੁਕਾਨ ਤੇ ਜੀ ਆਇਆ ਨੂੰ ਹਾਂਜੀ ਹਾਂਜੀ ਜਿਦਾ ਦਾ ਮਰਜੀ ਪਸੰਦ ਕਰੋ ਤੁਸੀਂ ਆ ਜਾਓ ਨਹੀਂ ਨਹੀਂ ਮੈਡਮ ਉਸੀ ਦਿਨ ਉਸੀ ਦਿਨ ਕੁਝ ਘੰਟਿਆਂ ਬਾਅਦ ਤੁਹਾਨੂੰ ਅਸੀਂ ਦੱਸ ਦਾਂਗੇ ਸਭ ਕੁਝ ਹੋ ਜਾਏਗਾ ਤੁਸੀਂ ਆ ਕੇ ਇੱਕ ਵਾਰ ਦੁਕਾਨ ਤੇ ਦੇਖ ਜਾਓ ਜੀ ਠੀਕ ਐ ਜੀ ਓਕੇ ਜੀ ਧੰਨਵਾਦ